ਪੰਜ ਅਕਤੂਬਰ ਉੱਨੀ ਸੌ ਇਕਹੱਤਰ ਅੱਠ ਜਨਵਰੀ ਉੱਨੀ ਸੌ ਪੰਜ ਇੱਕੀ ਦਸੰਬਰ ਦੋ ਹਜ਼ਾਰ ਚਾਰ ਦਸ ਜਨਵਰੀ ਉੱਨੀ ਸੌ ਬਾਈ ਸੱਤ ਨਵੰਬਰ ਉੱਨੀ ਸੌ ਬਹੱਤਰ